ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹਾਂਜੀ ਹਾਂਜੀ ਮੈਮ ਹਾਂਜੀ

ਹਾਂਜੀ ਹਾਂਜੀ ਮੈਮ ਜ਼ਰੂਰ ਮੈਂ ਤੁਹਾਨੂੰ ਦੱਸ ਦਿੰਦੀ ਕਿ ਪੰਜਾਬ 'ਚ ਜਿਹੜੀਆਂ ਹਿਸਟੋਰੀਕਲ ਪਲੇਸਿਸ ਆ ਜਿੱਥੇ ਕਿ ਤੁਸੀਂ ਜਾ ਸਕਦੇ ਆ ਅਤੇ ਤੁਹਾਡੇ ਨਜ਼ਦੀਕ ਵੀ ਹੈਗੀਆਂ ਆ ਸਭ ਤੋਂ ਪਹਿਲਾਂ ਤਾਂ ਮੈਮ ਅਨੰਦਪੁਰ ਸਾਹਿਬ ਹੀ ਆ ਉੱਥੇ ਤਾਂ ਇੱਕ ਤਾਂ ਤੁਹਾਨੂੰ ਗੁਰਦੁਆਰਾ ਮਿਲ ਜਾਏਗਾ ਠੀਕ ਆ ਜਿੱਥੇ ਤੁਸੀਂ ਕੇਸਗੜ੍ਹ ਸਾਹਿਬ ਗੁਰਦੁਆਰਾ ਤੁਸੀਂ ਉੱਥੇ ਜਾ ਸਕਦੇ ਆ ਮੱਥਾ ਟੇਕਣ ਅਤੇ ਇੱਥੇ ਹੋਰ ਵਿਰਾਸਤ ਏ ਖਾਲਸਾ ਵੀ ਹੈ ਤੁਸੀਂ ਉੱਥੇ ਵੀ ਜਾ ਸਕਦੇ ਹਿਸਟੋਰੀਕਲ ਪਲੇਸਿਸ ਹੈ ਬੱਚਿਆਂ ਲਈ ਵੀ ਕਾਫੀ ਵਧੀਆ ਜਗ੍ਹਾ ਏ ਆ ਘੁੰਮਣ ਲਈ ਵੀ ਅਤੇ ਇਸ ਤੋਂ ਇਲਾਵਾ ਤੁਸੀਂ ਮੈਮ ਅੰਮ੍ਰਿਤਸਰ ਜਾ ਸਕਦੇ ਆ ਗੋਲਡਨ ਟੈਂਪਲ ਅੰਮ੍ਰਿਤਸਰ ਅਤੇ ਤੁਹਾਡੇ ਚਾਰ ਪੰਜ ਵਿਜਿਟ ਉੱਥੇ ਹੋਜੂਗੇ ਇੱਕ ਤਾਂ ਅੰਮ੍ਰਿਤਸਰ ਹੋ ਜਾਣਾ ਇੱਕ ਉੱਥੇ ਬਾਘਾ ਬੋਡਰ ਹੈ ਅਟਾਰੀ ਬੋਡਰ ਜਿਹੜਾ ਤੁਸੀਂ ਉੱਥੇ ਜਾ ਸਕਦੇ ਆ ਇੱਕ ਜਲਿਆਂ ਵਾਲਾ ਬਾਗ ਹੈ ਠੀਕ ਹੈ ਉੱਥੇ ਜਾ ਕੇ ਕਾਫੀ ਸਾਰੀ ਉੱਥੇ ਇਨਫੋਰਮੇਸ਼ਨ ਵੀ ਬੱਚਿਆਂ ਨੂੰ ਮਿਲ ਸਕਦੀ ਹੈ ਉਸ ਜਗ੍ਹਾ ਤੋਂ ਉੱਥੇ ਵੀ ਜਾ ਸਕਦੇ ਆ ਹਿਸਟੋਰੀਕਲ ਪਲੇਸਿਸ 'ਤੇ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੋਰ ਵੀ ਕਾਫੀ ਸਾਰੇ ਟੈਂਪਲਸ ਵੀ ਨੇ ਉੱਥੇ ਕਾਫੀ ਸਾਰੇ ਦੁਰਗਿਆਣਾ ਮੰਦਰ ਹੈ ਉੱਥੇ ਉੱਥੇ ਜਾ ਸਕਦੇ ਓਂ ਅਤੇ ਅਗਰ ਹੋਰ ਗੱਲ ਕਰੇ ਜਲੰਧਰ ਦੀ ਤਾਂ ਜਲੰਧਰ ਵੀ ਤੁਸੀਂ ਦੇਵੀ ਤਲਾਬ ਮੰਦਰ ਹੈ ਮੈਮ ਨਵਾਂ ਸ਼ਹਿਰ ਦੇ ਨੀਅਰ ਅਬਾਊਟ ਤੁਹਾਨੂੰ ਜ਼ਿਆਦਾ ਨੇੜੇ ਅਨੰਦਪੁਰ ਸਾਹਿਬ ਪਵੇਗਾ ਅਤੇ ਜਲੰਧਰ ਪਵੇਗਾ ਤੁਸੀਂ ਇੱਥੇ ਜਾ ਸਕਦੇ ਹੋ ਜਲੰਧਰ ਦੇਵੀ ਤਲਾਬ ਮੰਦਰ ਹੈ ਕਾਫੀ ਫੇਮਸ ਉੱਤੇ ਵੀ ਜਾ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਹਾਂਜੀ ਅਗਰ ਕੋਈ ਹੋਰ ਇਨਫੋਰਮੇਸ਼ਨ ਹੋਈ ਦੈਨ ਯੂ ਕੈਨ ਕੋਲ ਮੀ ਐਨੀ ਟਾਈਮ ਓਕੇ ਓਕੇ ਜੀ ਓਕੇ